ਪੰਜਾਬ ਵਿੱਚ ਚੋਣਾਂ ਕਰਾਉਣ ਦੀ ਪ੍ਰਕਿਰਿਆ ਦੀ ਵਿਆਖਿਆ ਇਸ ਪ੍ਰਕਾਰ ਆ ਸਭ ਤੋਂ ਪਹਿਲਾਂ ਕੀ ਆ ਇਲੈਕਸ਼ਨ ਕਮਿਸ਼ਨ ਡਿਕਲੇਅਰ ਕਰਦਾ ਡੇਟ ਇਹ ਇਸ ਤਰੀਕ ਨੂੰ ਆਹ ਸਟੇਟ ਦੇ ਵਿੱਚ ਚੋਣਾਂ ਹੋਣੀਆਂ ਫਿਰ ਉੱਥੋਂ ਦੀ ਜਿਹੜੀ ਸਰਕਾਰ ਆ ਗਈ ਉਹ ਆਪਣੇ ਹਿਸਾਬ ਕਿਤਾਬ ਦੇ ਨਾਲ ਨੌਮੀਨੇਸ਼ਨ ਲਈ ਅਰਜ਼ੀਆਂ ਮੰਗਦੀ ਹੈ ਵੀ ਕਿਹੜੀ ਪਾਰਟੀ ਦਾ ਕਿਹੜਾ ਕੈਂਡੀਡੇਟ ਖੜ੍ਹਾ ਹੋਊਗਾ ਨੋਮੀਨੇਸ਼ਨ ਹੋ ਜਾਂਦੀ ਆ ਨੋਮੀਨੇਸ਼ਨ ਤੋਂ ਬਾਅਦ ਸਾਰੇ ਕੈਂਡੀਡੇਟ ਆਪਣਾ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਆ ਸਪੀਕਰ ਲਾਉਂਦੇ ਆ ਗੱਡੀਆਂ ਦਾ ਇਸਤੇਮਾਲ ਕਰਦੇ ਆ ਰੈਲੀਆਂ ਕਰਦੇ ਆ ਉਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਜਿਹੜੇ ਵੀ ਕਰਮਚਾਰੀਆਂ ਦੀ ਡਿਊਟੀ ਹੁੰਦੀ ਆ ਉਹਨਾਂ ਦੀਆਂ ਰਿਹਰਸਲਾਂ ਹੁੰਦੀਆਂ ਏ ਬੀ ਐਮ ਦੇ ਮਸ਼ੀਨ ਬਾਰੇ ਅਤੇ ਅਲੱਗ ਅਲੱਗ ਜਿੱਥੇ ਜਿੱਥੇ ਬੂਥ ਆ ਉਹਨਾਂ ਦੀ ਡਿਟੇਲਮੈਂਟ ਹੁੰਦੀ ਆ ਉਹ ਬੂਥਾਂ 'ਤੇ ਜਾਂਦੇ ਆ ਲੋਕਾਂ ਤੋਂ ਵੋਟਾਂ ਪਵਾਉਂਦੇ ਆ ਈ ਵੀ ਐੱਮ ਮਸ਼ੀਨ ਆ ਜਿਹੜੀ ਉਹ ਲੋਕ ਕਰਕੇ ਅੰਡਰ ਸਿਕਿਉਰਟੀ ਫੋਰਸ ਜ਼ਿਲ੍ਹੇ ਦੇ ਵਿੱਚ ਇੱਕ ਜਗ੍ਹਾ ਬਣੀ ਹੁੰਦੀ ਉੱਥੇ ਜਮਾਂ ਕਰਾ ਦਿੰਦੇ ਆ ਫਿਰ ਜਿਸ ਦਿਨ ਇਲੈਕਸ਼ਨ ਡਿਊਟੀ ਹੋਣ ਤੋਂ ਬਾਅਦ ਕੁਛ ਕਰਮਚਾਰੀਆਂ ਦੀ ਗਿਣਤੀ ਦੇ ਵਿੱਚ ਡਿਊਟੀ ਲੱਗਦੀ ਆ ਉਹ ਗਿਣਤੀ ਕਰਦੇ ਆ ਗਿਣਤੀ ਕਰਨ ਦੇ ਵਿੱਚੋਂ ਬਾਅਦ ਰਿਜਲਟ ਘੋਸ਼ਿਤ ਕਰਦੇ ਆ ਇਸ ਤਰੀਕੇ ਦੇ ਨਾਲ ਜਿਹੜੀ ਇਹ ਸਾਡੀ ਚੋਣ ਦੀ ਪ੍ਰਕਿਰਿਆ ਹੁੰਦੀ ਆ ਪੰਜਾਬ ਦੇ ਵਿੱਚ ਧੰਨਵਾਦ ਜੀ